ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਣਕ ਅਤੇ ਚਾਵਲ ਮੁੱਖ ਰੂਪ 'ਤੇ ਉਗਾਏ ਜਾਂਦੇ ਹਨ ਅਤੇ ਇਹ ਦੋਨੋਂ ਫ਼ਸਲਾਂ ਜਿਹੜੀਆਂ ਹਨ ਇਹ ਆਮ ਵਰਤੋਂ ਵਿੱਚ ਆਉਂਦੀਆਂ ਹਨ ਕਣਕ ਨੂੰ ਅਸੀਂ ਆਟਾ ਪੀਸ ਕੇ ਉਸਦਾ ਤੇ ਅਤੇ ਰੋਟੀ ਬਣਾ ਕੇ ਖਾਂਦੇ ਹਾਂ ਅਤੇ ਇਹ ਚਾਵਲ ਨੂੰ ਉਸੇ ਤਰ੍ਹਾਂ ਹੀ ਮੁੱਖ ਰੂਪ 'ਚ ਖਾਧਾ ਜਾਂਦਾ ਹੈ ਕਿਉਂਕਿ ਇਹ ਦੋਨੋਂ ਫ਼ਸਲਾਂ ਪੂਰੇ ਭਾਰਤ ਵਿੱਚ ਵਰਤੀਆਂ ਜਾਂਦੀਆਂ ਹਨ ਕਿਉਂਕਿ ਆਟਾ ਹਰ ਇਨਸਾਨ ਦੀ ਜ਼ਰੂਰਤ ਹੈ ਅਤੇ ਇਹ ਦੋਨੋਂ ਫ਼ਸਲਾਂ ਜਿਹੜੀਆਂ ਹਨ ਉਹ ਆਮ ਮਨੁੱਖਤਾ ਦੇ ਵਾਸਤੇ ਵੀ ਵਰਤੀਆਂ ਜਾਂਦੀਆਂ ਹਨ ਇਹ ਦੋਨੋਂ ਫ਼ਸਲਾਂ ਜਿਹੜੀਆਂ ਹਨ ਇਹ ਕਿਸਾਨ ਉਗਾ ਕੇ ਅਤੇ ਇਹਨਾਂ ਨੂੰ ਮੰਡੀ ਵਿੱਚ ਜਾ ਕੇ ਵੇਚਦੇ ਹਨ ਅਤੇ ਉਹ ਸਰਕਾਰ ਇਹਨਾਂ ਨੂੰ ਖਰੀਦ ਕੇ ਗੋਦਾਮਾਂ ਵਿੱਚ ਰੱਖ ਦਿੰਦੀਆਂ ਹਨ ਤਾਂ ਕਿ ਜ਼ਰੂਰਤ ਦੇ ਵੇਲੇ ਇਹ ਅੱਗੇ ਕੰਮ ਆ ਸਕਣ ਅਤੇ ਇਹ ਇਸ ਤੋਂ ਇਲਾਵਾ ਸਰ੍ਹੋਂ ਦਾ ਸਾਗ ਜਿਹੜਾ ਸਰਦੀਆਂ ਵਿੱਚ ਉਗਾਇਆ ਜਾਂਦਾ ਹੈ ਮੂਲੀ ਗਾਜਰ ਸ਼ਲਗਮ ਅਤੇ ਇਹ ਵੀ ਇੱਥੋਂ ਦੀਆਂ ਜਿਹੜੀਆਂ ਹਨ ਉਹ ਲੋਕਲ ਫ਼ਸਲਾਂ ਹਨ